ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਹਾਂਜੀ ਹਾਂਜੀ ਹਾਂਜੀ ਤੁਹਾਡੀਆਂ ਜੋ ਸਪੋਰਟਸ ਮੀਟ ਆ ਉਹ ਆ ਰਹੀਆਂ ਨੇ ਜਲਦੀ ਆ ਰਹੀਆਂ ਨੇ ਇਸ ਕਰਕੇ ਹੁਣ ਤੁਸੀਂ ਆਪਣੀ ਬੈਡਮਿੰਟਨ ਦੀ ਜੋ ਪ੍ਰੈਕਟਿਸ ਹੈ ਉਹ ਸ਼ੁਰੂ ਕਰ ਦਿਉ ਅਤੇ ਉਸਦੇ ਵਾਸਤੇ ਤੁਸੀਂ ਆਪਣੀ ਸਟੱਡੀ ਤੋਂ ਬਾਅਦ ਦੋ ਘੰਟੇ ਸ਼ਾਮ ਨੂੰ ਜ਼ਰੂਰ ਆਪਣੀ ਪ੍ਰੈਕਟਿਸ ਸੈਸ਼ਨ ਦੇ ਵਿੱਚ ਬਿਤਾਉ ਅਤੇ ਤੁਹਾਨੂੰ ਜਿਹੜੀ ਆ ਰਿਫਰੈਸ਼ਮੈਂਟ ਉਹ ਵੀ ਸਾਡੇ ਵੱਲੋਂ ਮੁਹੱਈਆ ਕਰਵਾਈ ਜਾਵੇਗੀ ਅਤੇ ਤੁਸੀਂ ਆਪਣਾ ਘਰ ਵੱਲੋਂ ਬਤਾਕਰ ਆਉ ਕਿ ਐਕਸਟਰਾ ਟਾਈਮ ਤੁਸੀਂ ਇੱਥੇ ਹੁਣ ਲਗਾਉਣਾ ਇਸ ਕਰਕੇ ਆਪਣੀ ਹੁਣ ਪ੍ਰੈਕਟਿਸ ਜਲਦੀ ਤੋਂ ਜਲਦੀ ਸ਼ੁਰੂ ਕਰ ਦੇਵੋ ਅਤੇ ਪੂਰੇ ਤੁਸੀਂ ਧਿਆਨ ਆਪਣੀ ਪ੍ਰੈਕਟਿਸ ਵੱਲ ਦੇਵੋ ਤਾਂ ਜੋ ਤੁਹਾਡੀਆਂ ਬਹੁਤ ਵਧੀਆ ਪੋਜ਼ੀਸ਼ਨ ਆਉਣ ਠੀਕ ਹੁਣ ਡੇਲੀ ਤੁਸੀਂ ਆਪਣਾ ਸਮਾਨ ਲੈ ਕੇ ਆਪਣਾ ਪਾਣੀ ਵਾਲੀ ਬੋਟਲ ਲੈ ਕੇ ਪ੍ਰੈਕਟਿਸ ਸੈਸ਼ਨ ਗਰਾਊਂਡ ਦੇ ਵਿੱਚ ਆਇਆ ਕਰਨਾ ਵਾ ਅਤੇ ਆਪਣਾ ਪੂਰਾ ਜਿਹੜਾ ਵਾ ਸੁਪਰੀਓ ਦੇਣਾ ਤੁਸੀਂ ਆਪਣੀ ਗੇਮ ਦੇ ਵਿੱਚ ਅਤੇ ਪ੍ਰੈਕਟਿਸ ਸੈਸ਼ਨ ਦੇ ਵਾਸਤੇ ਤੁਸੀਂ ਆਪਣੇ ਘਰੋਂ ਪੇਰੈਂਟਸ ਵੱਲੋਂ ਪਰਮੀਸ਼ਨ ਲੈ ਕੇ ਆਉ ਅਤੇ ਉਹਨਾਂ ਨੂੰ ਦੱਸੋ ਕਿ ਕਿੰਨੇ ਵਜੇ ਫਰੀ ਹੋਣਾ ਵਾ ਅਤੇ ਆਪਣੀ ਪ੍ਰੈਕਟਿਸ ਸੈਸ਼ਨ ਨੂੰ ਜਲਦੀ ਤੋਂ ਜਲਦੀ ਸਟਾਰਟ ਕਰੋ ਸਪੋਰਟਸ ਮੀਟ ਬਹੁਤ ਹੀ ਜਲਦ ਆ ਰਹੀਆਂ ਨੇ ਸੋ ਜਦ ਵੀ ਹੁਣ ਤਰੀਕ ਡੇਟਸ ਆਉਣਗੀਆਂ ਤੁਹਾਨੂੰ ਮੈਂ ਦੱਸ ਦੇਵਾਂਗਾ ਅਤੇ ਤੁਸੀਂ ਆਪਣੀਆਂ ਜੋ ਪ੍ਰੈਕਟਿਸ ਸੈਸ਼ਨ ਹੈ ਉਹ ਜਲਦੀ ਤੋਂ ਜਲਦੀ ਸਟਾਰਟ ਕਰੋ ਓਕੇ ਬੇਟਾ